ਹਾਲਾਂਕਿ ਮੇਰੇ ਕੋਲ ਨਿੱਜੀ ਅਨੁਭਵ ਜਾਂ ਕਹਾਣੀਆਂ ਨਹੀਂ ਹਨ ਮੈਂ ਯਕੀਨੀ ਤੌਰ ਤੇ ਕੁਝ ਪ੍ਰੇਰਨਾਦਾਇਕ ਕਿੱਸੇ ਸਾਂਝੇ ਕਰ ਸਕਦੀ ਹਾਂ ਕਿ ਕਿਵੇਂ ਭੰਗੜਾ ਐਰੋਬਿਕਸ ਨੇ ਲੋਕਾਂ ਦੇ ਜੀਵਨ ਨੂੰ ਸਕਾਰਾਤਮਕ ਤੌਰ ਤੇ ਪ੍ਰਭਾਵਿਤ ਕੀਤਾ ਹੈ ਇੱਕ ਕਹਾਣੀ ਜੋ ਸਾਹਮਣੇ ਆਉਂਦੀ ਹੈ ਉਹ ਪ੍ਰਿਆ ਨਾਮ ਦੀ ਇੱਕ ਔਰਤ ਦੀ ਹੈ ਤੇ ਉਹ ਭਾਰ ਪ੍ਰਬੰਧਨ ਅਤੇ ਘੱਟ ਊਰਜਾ ਦੇ ਪੱਧਰਾਂ ਨਾਲ ਸੰਘਰਸ਼ ਕਰ ਰਹੀ ਸੀ ਇੱਕ ਭੰਗੜਾ ਐਰੋਬਿਕਸ ਕਲਾਸ ਵਿੱਚ ਸ਼ਾਮਿਲ ਹੋਣ ਤੋਂ ਬਾਅਦ ਉਸਨੇ ਦੇਖਿਆ ਕਿ ਡਾਂਸ ਅਤੇ ਕਸਰਤ ਦੇ ਸੁਮੇਲ ਨੇ ਉਸਦੇ ਵਰਕਆਊਟ ਨੂੰ ਮਜੇਦਾਰ ਬਣਾਇਆ ਅਤੇ ਉਹ ਕੁਝ ਅਜਿਹਾ ਕਰਨ ਲਈ ਉਤਸੁਕ ਸੀ ਜੀਵਨਤ ਸੰਗੀਤ ਅਤੇ ਊਰਜਾਵਾਨ ਡਾਂਸ ਰੂਟੀਨ ਨੇ ਨਾ ਸਿਰਫ ਉਸਨੂੰ ਕੈਲੋਰੀ ਬਰਨ ਕਰਨ ਵਿੱਚ ਮਦਦ ਕੀਤੀ ਬਲਕਿ ਉਸਦੇ ਮੁੱਢ ਨੂੰ ਵੀ ਵਧਾਇਆ ਸਮੇਂ ਦੇ ਨਾਲ ਪ੍ਰੀਆ ਨੇ ਭਾਰ ਘਟਾਇਆ ਆਤਮ ਵਿਸ਼ਵਾਸ ਵਧਾਇਆ ਅਤੇ ਆਪਣੀਆਂ ਸੱਭਿਆਚਾਰਕ ਜੜਾਂ ਨਾਲ ਵਧੇਰੇ ਜੁੜਿਆ ਮਹਿਸੂਸ ਕੀਤਾ ਉਸਨੇ ਕਮਿਊਨਿਟੀ ਭੰਗੜਾ ਸਮਾਗਮਾਂ ਦਾ ਆਯੋਜਨ ਕਰਨਾ ਸ਼ੁਰੂ ਕਰ ਦਿੱਤਾ ਦੂਜਿਆਂ ਨੂੰ ਮੌਜ ਮਸਤੀ ਵਿੱਚ ਸ਼ਾਮਿਲ ਹੋਣ ਅਤੇ ਇੱਕ ਸਿਹਤਮੰਦ ਜੀਵਨਸ਼ੈਲੀ ਨੂੰ ਅਪਣਾਉਣ ਲਈ ਪ੍ਰੇਰਿਤ ਕੀਤਾ ਇੱਕ ਹੋਰ ਪ੍ਰੇਰਨਾਦਾਇਕ ਕਿੱਸਾ ਦੋਸਤਾਂ ਦੇ ਇੱਕ ਸਮੂਹ ਬਾਰੇ ਹੈ ਜਿਨਾਂ ਨੇ ਭੰਗੜਾ ਐਰੋਬਿਕਸ ਦੀ ਵਰਤੋਂ ਬੰਧਨ ਅਤੇ ਇਕੱਠੇ ਸਰਗਰਮ ਰਹਿਣ ਦੇ ਤਰੀਕੇ ਵਜੋਂ ਕੀਤੀ ਉਹ ਕਲਾਸਾਂ ਲਈ ਨਿਯਮਿਤ ਤੋਰ ਤੇ ਮਿਲਣਗੇ ਅਤੇ ਉਨਾਂ ਦੇ ਵਰਕਆਊਟ ਦਾ ਸਮਾਜਿਕ ਪਹਿਲੂ ਉਨਾਂ ਦੇ ਰੂਟੀਨ ਦਾ ਇੱਕ ਮਹੈਤਵਪੂਰਨ ਹਿੱਸਾ ਬਣ ਗਿਆ ਹੈ ਸਾਂਝੇ ਅਨੁਭਵ ਨੇ ਉਹਨਾਂ ਨੂੰ ਪ੍ਰੇਰਿਤ ਰਹਿਣ ਵਿੱਚ ਮਦਦ ਕੀਤੀ ਅਤੇ ਉਨਾਂ ਨੇ ਆਪਣੇ ਤੰਦਰੁਸਤੀ ਦੇ ਪੱਧਰਾ ਅਤੇ ਸਮੁੱਚੀ ਤੰਦਰੁਸਤੀ ਵਿੱਚ ਧਿਆਨ ਦੇਣ ਯੋਗ ਸੁਧਾਰ ਦੇਖਿਆ ਉਹਨਾਂ ਨੂੰ ਭੰਗੜਾ ਐਰੋਬਿਕਸ ਦੁਆਰਾ ਮਿਲੇ ਭਾਈਚਾਰੇ ਅਤੇ ਸਮਰਥਨ ਦੀ ਭਾਵਨਾ ਨੇ ਉਹਨਾਂ ਦੀ ਕਸਰਤ ਦੀ ਰੂਟੀਨ ਨੂੰ ਇੱਕ ਪਿਆਰੇ ਸਮਾਜਿਕ ਵਿੱਚ ਬਦਲ ਦਿੱਤਾ